ਹੈਲੋ ਬੰਬੀ ਕੀ ਹਾਲ ਚਾਲ ਨੇ ਤੇਰੇ ਮੈਂ ਵੀ ਵਧੀਆ ਹੋਰ ਪਲੱਸ ਟੂ ਦੇ ਪੇਪਰ ਕਿੱਦਾਂ ਦੇ ਗਏ ਮੇਰੇ ਵੀ ਬਹੁਤ ਵਧੀਆ ਗਏ ਹੁਣ ਦੇਖੋ ਰਿਜਲਟ ਕਿੱਦਾਂ ਦਾ ਆਉਂਦਾ ਅੱਗੇ ਬਾਰੇ ਕੀ ਸੋਚਣਾ ਨੋਨ ਮੈਡੀਕਲ ਲਾਈਨ ਆ ਸਾਡੀ ਅਤੇ ਹੁਣ ਇੰਜੀਨੀਅਰਿੰਗ ਹੀ ਕਰਾਂਗੇ ਸੋਚਦੇ ਆ ਕੋਈ ਸੋਚਿਆ ਕੋਈ ਪਠਾਨਕੋਟ ਡਿਸਟ੍ਰਿਕਟ ਵਿੱਚ ਹੀ ਸਾਨੂੰ ਵਧੀਆ ਕਾਲਜ ਮਿਲ ਜਾਵੇ ਬਾਕੀ ਸਾਡਾ ਹਾਂ ਹਾਂ ਮੈਂ ਵੀ ਸੁਣਿਆ ਕਿ ਸ਼੍ਰੀ ਸਾਈ ਕਾਲਜ ਬਹੁਤ ਵਧੀਆ ਅਤੇ ਇੰਜੀਨੀਅਰਿੰਗ ਵਾਸਤੇ ਪਲੇਸਮੈਂਟ ਵੀ ਬੜੀ ਜਲਦੀ ਆ ਜਾਂਦੀ ਹੈ ਨਾਲ ਸਾਡੇ ਦੋਨਾਂ ਦਾ ਸਾਥ ਹੋ ਜਾਵੇਗਾ ਇਕੱਠੇ ਜਾਵਾਂਗੇ ਇਕੱਠੇ ਆਵਾਂਗੇ ਘਰ ਚਲੋ ਹਾਂ ਮੈਂ ਵੀ ਕਰਾਂਗੀ ਗੱਲ ਘਰਦਿਆਂ ਨਾਲ ਦੱਸਾਂਗੀ ਕਿ ਵਧੀਆ ਕਾਲਜ ਆ ਫੀਸ ਵੀ ਘੱਟ ਇੱਥੋਂ ਦੀ ਬਾਕੀਆਂ ਨਾਲੋਂ ਕੰਪੇਅਰ ਕੀਤਾ ਜਾਵੇ ਅਤੇ ਟੀ ਇੱਥੋਂ ਦੇ ਟੀਚਰ ਵੀ ਕਾਫ਼ੀ ਐਕਸਪੀਰੀਅੰਸਡ ਆ ਚੱਲੋ ਠੀਕ ਹੈ ਕੱਲ ਕਰਦੀ ਹਾਂ ਮੈਂ ਤੈਨੂੰ ਕੋਲ ਪੁੱਛ ਕੇ ਪੇਰੈਂਟਸ ਤੋਂ ਓਕੇ